ਹਾਂਜੀ ਹਾਂਜੀ ਸਰ ਸਾਈਂ ਟਰੈਵਲਰ ਤੋਂ ਬੋਲ ਰਹੇ ਹੋ ਅੱਛੇ ਅੱਛੇ ਸਰ ਸਰ ਮੈਂ ਨਾ ਕੱਲ੍ਹ ਇੱਕ ਕੈਬ ਬੁੱਕ ਕੀਤੀ ਸੀ ਮੁਨੀ ਚੌਂਕ ਤੋਂ ਰਾਮਤੀਰਥ ਰੋਡ ਅੰਮ੍ਰਿਤਸਰ ਦੀ ਅਤੇ ਉਨਦੀ ਮੈਂ ਪੇਮੈਂਟ ਵੀ ਕਰ ਦਿੱਤੀ ਹੈ ਪਰ ਸਰ ਮੇਰਾ ਨਾ ਕੋਈ ਐਮਰਜੈਂਸੀ ਮੈਨੂੰ ਇੱਦਾਂ ਦਾ ਕੋਈ ਕੰਮ ਆ ਗਿਆ ਕਿ ਮੈਂ ਨਹੀਂ ਜਾ ਸਕਦੀ ਅਤੇ ਮੈਂ ਰੱਦ ਕਰਵਾ ਤੀ ਸੀ ਅਤੇ ਤੁਸੀਂ ਕਿਹਾ ਸੀ ਕਿ ਤੁਹਾਡੀ ਪੇਮੈਂਟ ਕੁਛ ਘੰਟਿਆਂ 'ਚ ਆ ਜਾਏਗੀ ਲੇਕਿਨ ਕੱਲ੍ਹ ਸ਼ਾਮ ਦੀ ਅਜੇ ਤੱਕ ਸਰ ਮੈਨੂੰ ਪੇਮੈਂਟ ਨਹੀਂ ਆਈ ਅਤੇ ਇਨਦਾ ਰੀਜਨ ਦੱਸੋ ਬਾਕੀ ਜੇ ਤੁਸੀਂ ਪੇਮੈਂਟ ਰਿਫੰਡ ਨਹੀਂ ਕੀਤੀ ਤਾਂ ਤੁਸੀਂ ਇੱਦਾਂ ਕਰੋ ਮੈਂ ਅੱਜ ਜਾਣਾ ਵੈਂ ਮੁਨੀ ਚੌਂਕ ਤੋਂ ਉਸੇ ਜਗ੍ਹਾ ਤੋਂ ਹੀ ਅਤੇ ਅੱਜ ਮੈਂ ਜਾਣਾ ਰਣਜੀਤ ਐਵਨਿਊ ਅਤੇ ਤੁਸੀਂ ਉਹੀ ਪੈਸਿਆਂ ਨੂੰ ਐਡਜਸਟ ਕਰ ਦਿਓ ਅਤੇ ਕੈਬ ਬੁੱਕ ਕਰ ਲਉ ਜੇ ਨਹੀਂ ਕਰ ਸਕਦੇ ਸਰ ਤਾਂ ਪਲੀਜ਼ ਮੈਨੂੰ ਦੱਸ ਦਿਓ ਮੈਂ ਫਿਰ ਕਿਤੇ ਹੋਰ ਕੈਬ ਬੁੱਕ ਕਰਾਵਾਂ ਅਤੇ ਮੇਰੇ ਪੈਸੇ ਰਿਫੰਡ ਕਰ ਦਿੱਤੇ ਜਾਣ ਹਾਂਜੀ ਹਾਂਜੀ ਸਰ ਹਾਂਜੀ ਅਤੇ ਸਰ ਤੁਸੀਂ ਇੱਦਾਂ ਕਰੋ ਕਿ ਮੈਨੂੰ ਨਾ ਤੁਸੀਂ ਛੇ ਵਜੇ ਇੱਥੋਂ ਪਿੱਕਅਪ ਕਰ ਲੈਣਾ ਮੁਨੀ ਚੌਂਕ ਤੋਂ ਅਤੇ ਰਣਜੀਤ ਐਵਨਿਊ ਮੈਂ ਜਾਣਾ ਮੈਨੂੰ ਉਹਦੀ ਪੇਮੈਂਟ ਦੱਸ ਦਿਉ ਕਿੰਨੀ ਹੈ ਅਤੇ ਉਨਦੇ ਵਿੱਚ ਹੀ ਤੁਸੀਂ ਪੈਸੇ ਕੱਟ ਕਰ ਲੈਣਾ ਐਡਜਸਟ ਕਰਕੇ ਅਤੇ ਮੈਨੂੰ ਦੱਸ ਦਿਉ ਕਿ ਮੁਨੀ ਚੌਂਕ ਤੋਂ ਰਣਜੀਤ ਐਵੇਨਿਊ ਜਾਣ ਲਈ ਕਿੰਨੀ ਪੇਮੈਂਟ ਹੈ ਅਤੇ ਬਾਕੀ ਪੈਸੇ ਮੇਰੇ ਰਿਫੰਡ ਕਰ ਦਿੱਤੇ ਜਾਣ ਹਾਂਜੀ ਸਰ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਮੈਨੂੰ ਰਿਫੰਡ ਕਰ ਦਿਉ ਅਤੇ ਮੈਂ ਫਿਰ ਕੋਈ ਦੂਸਰੀ ਕੈਬ ਬੁੱਕ ਕਰਾਵਾਂ ਕਿਉਂਕਿ ਮੇਰਾ ਜਾਣਾ ਜ਼ਰੂਰੀ ਹੈ ਹਾਂਜੀ ਮੈਨੂੰ ਪਲੀਜ਼ ਜਲਦੀ ਤੋਂ ਜਲਦੀ ਦੱਸ ਦਿਉ ਹਾਂਜੀ ਹਾਂਜੀ ਸਰ ਓਕੇ ਸਰ ਹੋ ਜਾਏਗਾ ਅਜਸਟਮੈਂਟ ਓਕੇ ਸਰ ਓਕੇ ਸਰ